ਦੋ ਹਜ਼ਾਰ ਚੌਦ੍ਹਾਂ ਵਿੱਚ ਜਦੋਂ ਮੈਂ ਆਪਣੇ ਕਾਲਜ ਵਿੱਚ ਮਹਿੰਦਰਾ ਕਾਲਜ ਦਾਖਲਾ ਲਿਆ ਤਾਂ ਮੇਰੇ ਇੱਕ ਦੋਸਤ ਨੇ ਮੈਨੂੰ ਬੜੀ ਚੰਗੀ ਸਲਾਹ ਦਿੱਤੀ ਕਿ ਤੂੰ ਕਿਤਾਬਾਂ ਪੜ੍ਹਿਆ ਕਰ ਜਿਸ ਦਾ ਕਿ ਜ਼ਿੰਦਗੀ ਵਿੱਚ ਬਹੁਤ ਵੱਡਾ ਫਾਇਦਾ ਹੈ ਅਤੇ ਉਸ ਨੇ ਮੈਨੂੰ ਸਭ ਤੋਂ ਪਹਿਲਾਂ ਇੱਕ ਕਿਤਾਬ ਦਿੱਤੀ ਜਿਸ ਦਾ ਨਾਮ ਸੀ ਦਰ ਦਰਵਾਜ਼ੇ ਜੋ ਕਿ ਪੰਜਾਬ ਦੇ ਪ੍ਰਸਿੱਧ ਲੇਖਕ ਨਰਿੰਦਰ ਸਿੰਘ ਕਪੂਰ ਨੇ ਲਿਖੀ ਸੀ ਜਦੋਂ ਮੈਂ ਉਸ ਕਿਤਾਬ ਨੂੰ ਵੈਸੇ ਤਾਂ ਮੇਰਾ ਕੋਈ ਵੀ ਖਿਆਲ ਨਹੀਂ ਸੀ ਕਿ ਮੈਂ ਕਿਤਾਬ ਪੜ੍ਹਾਂ ਪਰ ਜਦੋਂ ਮੈਂ ਉਹ ਕਿਤਾਬ ਪਹਿਲੀ ਵਾਰੀ ਪੜ੍ਹੀ ਤਾਂ ਮੈਂ ਉਸ ਕਿਤਾਬ ਨੂੰ ਕਮ ਘੱਟੋ ਘੱਟ ਵੀਹ ਪੇਜ ਪੜ੍ਹੇ ਤਾਂ ਉਹ ਕਿਤਾਬ ਮੈਨੂੰ ਇੱਕ ਇੱਕ ਲਾਇਨ ਇਉਂ ਸਮਝਾਉਂਦੀ ਸੀ ਜਿਵੇਂ ਮੈਂ ਕਿਸੇ ਇਨਸਾਨ ਨਾਲ ਗੱਲਾਂ ਕਰ ਰਿਹਾ ਹੋਵਾਂ ਉਸਨੇ ਬਹੁਤ ਸਾਰੇ ਜ਼ਿੰਦਗੀ ਦੇ ਬਾਰੀਕ ਤੱਥਾਂ ਉੱਤੇ ਕੰਮ ਕਰਦੇ ਹੋਏ ਬਹੁਤ ਸਾਰੇ ਮੇਰੇ ਨਿੱਜੀ ਜੀਵਨ ਵਿੱਚ ਚੇਂਜ ਲਿਆਂਦਾ ਅਤੇ ਮੈਂ ਉਸਨੂੰ ਆਪਣੇ ਕੰਮਾਂ ਵਿੱਚ ਵੀ ਚੈੱਕ ਕੀਤਾ ਕਈ ਵਾਰੀ ਤਾਂ ਮੈਂ ਉਸ ਕਿਤਾਬ ਬਾਰੇ ਸੋਚਦਾ ਸੋਚਦਾ ਬਹੁਤ ਹੀ ਡੂੰਘਾ ਲੰਘ ਜਾਂਦਾ ਸੀ ਅਤੇ ਕੁਛ ਮੈਂ ਸ਼ਾਇਰੀ ਵੀ ਉਸ ਕਿਤਾਬ ਦੇ ਬੇਸ 'ਤੇ ਲਿਖੀ ਪਰ ਮੈਂ ਅੱਜ ਤੱਕ ਕਿਸੇ ਵੀ ਰੀਡਿੰਗ ਕਲੱਬ ਵਿੱਚ ਸ਼ਾਮਿਲ ਨਹੀਂ ਹੋਇਆ ਕਿਉਂਕਿ ਮੇਰੇ ਕੋਲ ਘਰ ਹੀ ਬਹੁਤ ਸਾਰੀਆਂ ਕਿਤਾਬਾਂ ਪਈਆਂ ਹਨ ਜੋ ਕਿ ਮੈਂ ਬਹੁਤ ਅੱਛੀ ਤਰ੍ਹਾਂ ਅਤੇ ਸੰਭਾਲ ਕੇ ਪੜ੍ਹਦਾ ਰਹਿੰਦਾ ਹਾਂ